ਬਾਲੀਵੁੱਡ ਜਾਂ ਟਾਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਰੋਜਾਨਾ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਬਹੁਤ ਸਾਰੀਆਂ ਫਿਲਮਾਂ ਸੀਰੀਜ਼ ਜਾਂ ਫਿਰ ਟੈਲੀਵਿਜ਼ਨ 'ਤੇ ਆਉਣ ਵਾਲੇ ਡੇਲੀ ਸੋਪ ਦੇ ਵਿੱਚ ਜੋ ਕੱਪੜੇ ਜਾਂ ਜਿਹੋ ਜੇ ਉਹ ਡਰੈਸਿੰਗ ਸੈਂਸ ਹੈ ਅਸੀਂ ਉਹਨਾ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੁਛ ਸਾਲ ਪਹਿਲਾਂ ਇੱਕ ਸੀਰੀਅਲ ਆਉਂਦਾ ਸੀਗਾ ਜੋਧਾ ਅਕਬਰ ਓਹਦੇ ਵਿੱਚ ਜਿਹੜੀ ਜੋਧਾ ਸੀਗੀ ਉਸ ਦਾ ਜੋ ਪਹਿਰਾਵਾ ਸੀ ਉਹ ਬਹੁਤ ਹੀ ਦਿਲਕਸ਼ ਸੀ ਮੈਨੂੰ ਉਹ ਬਹੁਤ ਅੱਛਾ ਲੱਗਦਾ ਹੁੰਦਾ ਸੀ ਜਦੋਂ ਜੋਧਾ ਨੇ ਜਿਹੜੇ ਲਹਿੰਗੇ ਪਾਉਂਦੀ ਜਾਂ ਫਿਰ ਓਹਦੇ ਨਾਲ ਓਹਦੀ ਨੱਥਨੀ ਓਹਦੇ ਕੰਨਾਂ ਦੇ ਓਹਦੀ ਜੁਐਲਰੀ ਸਾਰੀ ਨੂੰ ਬਹੁਤ ਹੀ ਆਕਰਸ਼ਿਤ ਕਰਦੇ ਸਨ ਮੈਂ ਕਿਤੇ ਨਾ ਕਿਤੇ ਮਨ ਹੀ ਮਨ ਸੋਚਦੀ ਕਿ ਜਿਸ ਦਿਨ ਮੇਰੀ ਸ਼ਾਦੀ ਹੋਊਗੀ ਤਾਂ ਮੈਂ ਇਸੇ ਤਰਾਂ ਹੀ ਤਿਆਰ ਹੋਊਗੀ ਮੈਂ ਜਿਵੇਂ ਜੋਧਾ ਤਿਆਰ ਹੁੰਦੀ ਹੈ ਤਾਂ ਇੱਕ ਦਿਨ ਉਹ ਵੀ ਆਇਆ ਮੇਰਾ ਖੁਦ ਦਾ ਵਿਆਹ ਸੀਗਾ ਤਾਂ ਮੈਂ ਬਹੁਤ ਹੀ ਦੁਕਾਨਾਂ ਤੇ ਭੱਜ ਦੋੜ ਕਰਕੇ ਆਪਣਾ ਦੁਕਾਨਦਾਰਾਂ ਨੂੰ ਸਮਝਾ ਸਮਝਾ ਕੇ ਇੱਕ ਇਹੋ ਜਾ ਲਹਿੰਗਾ ਤਿਆਰ ਕਰਵਾਇਆ ਜਿਹੜਾ ਕਿ ਹੂ ਬ ਹੂ ਜਿਵੇਂ ਦਾ ਜੋਧਾ ਪਾਉਂਦੀ ਸੀ ਮੈਂ ਉਵੇਂ ਦਾ ਲਹਿੰਗਾ ਸਵਾ ਲਿਆ ਉਸ ਦੇ ਨਾਲ ਜਿਹੜੀ ਜੁਐਲਰੀ ਜਾਂ ਨੱਥਨੀ ਹੈ ਨੱਥਨੀ ਮੈਂ ਵੈਸੇ ਆਪਣੇ ਕਦੀ ਨਹੀਂ ਪਾਈ ਪਰ ਮੈਂ ਆਪਣੇ ਵਿਆਹ ਤੇ ਉਹ ਨੱਥਨੀ ਪਾਈ ਤਾਂ ਮੈਨੂੰ ਆਪਣੇ ਆਪ ਜੋ ਕਿਤੇ ਨਾ ਕਿਤੇ ਜੋਧਾ ਦਿਖਾਈ ਦੇ ਰਹੀ ਸੀ ਅਗਰ ਮੈਂ ਕਹਾਂ ਤਾਂ ਇਹ ਸਾਰਾ ਜੋ ਪਹਿਰਾਵਾ ਜਾਂ ਜੋ ਮੈਂ ਆਪਣੇ ਵਿਆਹ ਦੇ ਉੱਪਰ ਲਹਿੰਗਾ ਪਾਇਆ ਸੀ ਤਾਂ ਮੈਂ ਉਸੇ ਨੂੰ ਹੀ ਜੋਧਾ ਦੇ ਪਾਤਰ ਨੂੰ ਦੇਖ ਕੇ ਹੀ ਉਹ ਸਾਰਾ ਕੁਛ ਤਿਆਰ ਕਰਵਾਇਆ ਸੀ ਮੈਂ ਓਹ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਿਤ ਸੀ ਤਾਂ ਕਿਤੇ ਨਾ ਕਿਤੇ ਮੈਂ ਉਹਦੇ ਵਰਗੀ ਹੀ ਲੱਗਣਾ ਚਾਹੁੰਦੀ ਸੀ ਤਾਂ ਮੈਂ ਬਹੁਤ ਖੁਸ਼ ਸੀ ਕਿ ਮੈਂ ਉਵੇਂ ਦੀ ਸ਼ੈਲੀ ਜਿਹੜੀ ਹੈ ਕੱਪੜਿਆਂ ਦੀ ਬਣਵਾ ਸਕੀ